ਹਾਂਜੀ ਬਾਪੂ ਜੀ ਇੱਦਾਂ ਕਰਿਓ ਜਦੋਂ ਤੁਸੀਂ ਜਾਊਂਗੇ ਨਾ ਏ ਟੀ ਐੱਮ ਮਸ਼ੀਨ ਦੇ ਵਿੱਚ ਉੱਥੇ ਕਾਰਡ ਪਾਓਂਗੇ ਜਦੋਂ ਤੁਸੀਂ ਉੱਥੇ ਨਾ ਲਾਈਟ ਮੱਚਦੀ ਬੁੱਝਦੀ ਆ ਉੱਥੇ ਕਾਰਡ ਪੈਂਦਾ ਹੁੰਦਾ ਕਾਰਡ ਪਾਇਆ ਜਦੋਂ ਤੁਸੀਂ ਠੀਕ ਹੈ ਉਹਨੇ ਕੜਕ ਜੀ ਦੀ ਆਵਾਜ਼ ਕੀਤੀ ਤਾਂ ਮਤਲਬ ਉਹ ਏ ਟੀ ਐੱਮ ਤੁਹਾਡਾ ਨਿਕਲੂਗਾ ਨਹੀਂ ਟਰਾਂਜੈਕਸ਼ਨ ਪੂਰੀ ਤੁਹਾਨੂੰ ਸਾਰਾ ਪੈਸਾ ਕਢਵਾਉਣ ਤੋਂ ਬਾਅਦ ਨਿਕਲੂਗਾ ਏ ਟੀ ਐੱਮ ਜੇ ਉਹਨੇ ਆਵਾਜ਼ ਨਾ ਕਰੀ ਤਾਂ ਉਹ ਪਹਿਲਾਂ ਵੀ ਨਿਕਲ ਜੂਗਾ ਕੱਢਣਾ ਹੋਇਆ ਫਿਰ ਤੁਸੀਂ ਪਹਿਲਾਂ ਕੱਢ ਲਿਓ ਠੀਕ ਹੈ ਨਹੀਂ ਬਾਅਦ 'ਚ ਕੱਢ ਲਿਓ ਟਰਾਂਜੈਕਸ਼ਨ ਪੂਰੀ ਕਰਨ ਤੋਂ ਬਾਅਦ ਪੈਸੇ ਕਢਾਉਣ ਤੋਂ ਬਾਅਦ ਹੀ ਕੱਢਿਓ ਅਤੇ ਐਂ ਆ ਕਿ ਜਦੋਂ ਤੁਸੀਂ ਉਹ ਪਾਉਂਗੇ ਤੁਹਾਨੂੰ ਸਕਰੀਨ ਦੇ ਉੱਤੇ ਜਿਹੜਾ ਹੈਗਾ ਲੈਂਗੁਏਜ ਭਾਸ਼ਾ ਦੀ ਆਪਸ਼ਨ ਆ ਜੂਗੀ ਅੰਗਰੇਜ਼ੀ ਪੰਜਾਬੀ ਹਿੰਦੀ ਤੁਸੀਂ ਪੰਜਾਬੀ ਆਉਂਦੀ ਹੈ ਤੁਹਾਨੂੰ ਪੰਜਾਬੀ 'ਤੇ ਦੱਬ ਦਿਓ ਠੀਕ ਹੈ ਪੰਜਾਬੀ ਦੱਬ ਕੇ ਉਸ ਤੋਂ ਬਾਅਦ ਤੁਹਾਨੂੰ ਉਹ ਪੈਸੇ ਪੁੱਛੂਗਾ ਕਿੰਨੇ ਕਢਾਉਣੇ ਨੇ ਤੁਸੀਂ ਖਾਤਾ ਪੁੱਛੂਗਾ ਪਹਿਲਾਂ ਖਾਤਾ ਕਿਹੜਾ ਸੇਵਿੰਗ ਹੈ ਚਾਲੂ ਹੈ ਤਾਂ ਬੱਚਤ ਖਾਤਾ ਜਿਹੜਾ ਸੇਵਿੰਗ ਵਾਲਾ ਹੁੰਦਾ ਉਹ ਦੱਬਿਓ ਬੱਚਤ ਖਾਤਾ ਬੱਚਤ ਖਾਤੇ ਤੋਂ ਬਾਅਦ ਤੁਸੀਂ ਜਾਣਾ ਹੈਗਾ ਆਪਣਾ ਅਮਾਊਂਟ ਰਕਮ ਭਰਨ 'ਤੇ ਰਕਮ ਭਰ ਕੇ ਹਰੇ ਬਟਨ ਨਾਲ਼ ਓਕੇ ਕਰਿਓ ਫਿਰ ਤੁਹਾਨੂੰ ਉਹ ਮੰਗੂਗਾ ਤੁਹਾਡਾ ਪਿੰਨ ਪਿੰਨ ਜਿਹੜਾ ਹੈਗਾ ਦੱਬ ਕੇ ਫਿਰ ਤੁਹਾਡਾ ਪੈਸੇ ਨਿਕਲਣਗੇ ਪੈਸੇ ਲੈ ਕੇ ਫਿਰ ਤੁਸੀਂ ਏ ਟੀ ਐੱਮ ਕੱਢਣਾ ਠੀਕ ਹੈ ਪੈਸੇ ਲੇਣ ਤੋਂ ਬਾਅਦ ਏ ਟੀ ਐੱਮ ਜ਼ਰੂਰ ਕੱਢ ਲਿਓ ਭੁੱਲ ਨਾ ਜਾਇਓ